ਪਹਿਲਾਂ ਅਸੀਂ ਕਾਫੀ ਟਾਈਮ ਪਹਿਲਾਂ ਗੱਡੀ 'ਤੇ ਗਏ ਸੀ ਇੱਧਰ ਹਿਮਾਚਲ ਵੱਲ ਪਰ ਇੱਕ ਵਾਰੀ ਮੌਕਾ ਮਿਲਿਆ ਮੈਨੂੰ ਸਾਈਕਲ 'ਤੇ ਜਾਣ ਦਾ ਹਿਮਾਚਲ ਮੰਡੀ ਜ਼ਿਆਦਾ ਸ਼ਹਿਰ ਮੰਡੀ 'ਚ ਗਏ ਸੀ ਅਸੀਂ ਮਨੀਕਰਨ ਸਾਹਿਬ 'ਚ ਅਤੇ ਜਾਂਦੇ ਗਏ ਸੀ ਜਦੋਂ ਪੰਜਾਬ ਟੱਪ ਗਏ ਅਤੇ ਅਸੀਂ ਕਾਫੀ ਜਾਣੇ ਸੀਗੇ ਬਠਿੰਡੇ ਤੋਂ ਸਾਈਕਲ 'ਤੇ ਉੱਥੇ ਵੀ ਸਾਨੂੰ ਅੱਗੇ ਜਦੋਂ ਹਿਮਾਚਲ ਜਾ ਵੜੇ ਸੀ ਮੰਡੀ 'ਚ ਉੱਥੇ ਸਾਨੂੰ ਕਾਫੀ ਸਾਈਕਲਾਂ ਵਾਲੇ ਮਿਲ ਗਏ ਅਤੇ ਰਸਤਾ ਬਹੁਤ ਖਰਾਬ ਕਿਤੇ ਉੱਚਾ ਨੀਵਾਂ ਭੀੜਾ ਐਂ ਇੱਕ ਪਾਸੇ ਤਾਂ ਸਾਰੇ ਖਾਈ ਹੁੰਦੀ ਆ ਨਦੀ ਹੁੰਦੀ ਹੈ ਮੰਨ ਲਓ ਉਹ 'ਚ ਪਾਣੀ ਕਿਤੇ ਵੱਧ ਕਦੇ ਘੱਟ ਅਤੇ ਡਰ ਲੱਗਦਾ ਪੂਰਾ ਸਾਈਕਲ ਚਲਾਉਂਦੇ ਨੂੰ ਵੀ ਇੱਕ ਦੋ ਵਾਰੀ ਪੈਂਚਰ ਵੀ ਹੋਇਆ ਸਾਈਕਲ ਅਤੇ ਸਾਡਾ ਪੰਪ ਵੀ ਖਰਾਬ ਹੋ ਗਿਆ ਅਤੇ ਇੱਕ ਵਾਰ ਟਿਊਬ ਵੀ ਫਟ ਗਈ ਬਿਲਕੁਲ ਅਤੇ ਸਾਨੂੰ ਕਾਫੀ ਮੈਨੂੰ ਦੂਰ ਤੁਰ ਕੇ ਜਾਣਾ ਪਿਆ ਅਤੇ ਕਾਫੀ ਦਿੱਕਤ ਆਈ ਉੱਥੇ ਫਿਰ ਉਹ ਤੋਂ ਬਾਅਦ ਅਸੀਂ ਵਾਪਸ ਆ ਗਏ ਅਤੇ ਕਾਫੀ ਦਿਨਾਂ ਬਾਅਦ ਫਿਰ ਅਸੀਂ ਇੱਕ ਟੂਰ ਇੱਧਰ ਰਾਜਸਥਾਨ ਦਾ ਕੱਢਿਆ ਸਾਲਾਸਰ ਵੱਲ ਅਤੇ ਉੱਥੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਉਤੋਂ ਸਾਈਕਲ ਚਲਾਉਣਾ ਬਹੁਤ ਹੀ ਔਖੇ ਹੋਏ ਮੰਡੀ ਨਾਲੋਂ ਇੱਧਰ ਜ਼ਿਆਦਾ ਔਖੇ ਹੋਏ ਅਸੀਂ ਜਾਣ